ਸਤਿ ਸ਼੍ਰੀ ਅਕਾਲ ਸਰ ਮੈਂ ਹਰਜੀਤ ਕੌਰ ਪਠਾਨਕੋਟ ਤੋਂ ਬੋਲ ਰਹੀ ਹਾਂ ਮੈਂ ਤੁਹਾਡੀ ਸ਼ੋਪ ਤੋਂ ਸੂਟ ਬੁੱਕ ਕਰਵਾਇਆ ਸੀ ਜੋ ਛੇ ਕੁ ਸੌ ਦੀ ਰੇਂਜ ਵਿੱਚ ਹੈਗਾ ਸੀ ਆਪਣੀ ਬੇਟੀ ਲਈ ਬੁੱਕ ਕਰਵਾਇਆ ਸੀ ਅਤੇ ਮੇਰੀ ਬੇਟੀ ਨੇ ਉਹ ਸੂਟ ਪਾ ਕੇ ਤਿੰਨ ਚਾਰ ਫੰਕਸ਼ਨ ਵੀ ਅਟੈਂਡ ਕੀਤੇ ਕੁਛ ਸਕੂਲ ਦੇ ਫੰਕਸ਼ਨ ਵੀ ਕੀਤੇ ਕੁਛ ਅਸੀਂ ਇੱਕ ਵਿਆਹ ਦੀ ਪਾਰਟੀ ਵੀ ਅਟੈਂਡ ਕੀਤੀ ਜੋ ਸੂਟ ਸਭ ਨੇ ਬਹੁਤ ਪਸੰਦ ਕੀਤਾ ਦੋ ਵਾਰ ਅ ਉਸ ਸੂਟ ਨੂੰ ਮੈਂ ਆਣ ਕੇ ਧੋਤਾ ਵੀ ਆ ਧੋ ਕੇ ਫਿਰ ਵੀ ਉਸਨੇ ਪਾਇਆ ਉਸ ਤੋਂ ਬਾਅਦ ਫਿਰ ਇੱਕ ਫੰਕਸ਼ਨ ਦੇਖਿਆ ਫਿਰ ਵੀ ਸੂਟ ਬਹੁਤ ਵਧੀਆ ਰਿਹਾ ਮੈਨੂੰ ਤੁਹਾਡੇ ਸ਼ ਸ਼ੋਪ ਦਾ ਸੂਟ ਬਹੁਤ ਪਸੰਦ ਆਇਆ ਮੈਂ ਚ ਮੇਰਾ ਕਹਿਣ ਦਾ ਇਹ ਮਤਲਬ ਹੈ ਕਿ ਮੈਂ ਤੁਹਾਡੇ ਕੋਲ ਇੱਕ ਹੋਰ ਸੂਟ ਖਰੀਦਣਾ ਚਾਹੁੰਦੀ ਹਾਂ ਮੈਂ ਪਠਾਨਕੋਟ ਆਵਾਂਗੀ ਅਤੇ ਤੁਹਾਡੇ ਕੋਲ ਆ ਕੇ ਅਤੇ ਤੁਹਾਡੀ ਸ਼ੋਪ ਤੋਂ ਕੁਝ ਇੱਕ ਦੋ ਸੂਟ ਹੋਰ ਖਰੀਦਾਂਗੀ ਜੋ ਕਿ ਮੈਨੂੰ ਬੜੇ ਪਸੰਦ ਆਏ ਹਨ ਅਤੇ ਮੈਂ ਕੁਝ ਜੀਨ ਕੁਛ ਟੋਪ ਅਤੇ ਕੁਛ ਬੱਚਿਆਂ ਲਈ ਕੱਪੜੇ ਵੀ ਖਰੀਦਣਾ ਚਾਹੁੰਦੀ ਹਾਂ